ਹਾਂਜੀ ਮੈਮ ਸਤਿ ਸ਼੍ਰੀ ਅਕਾਲ ਮੈਮ ਤੁਸੀਂ ਦੱਸੋ ਠੀਕ ਠਾਕ ਹੋ ਤੁਸੀਂ ਹਾਂਜੀ ਹਾਂਜੀ ਮੈਮ ਅਸੀਂ ਵੈਡਿੰਗ ਦੇ ਲਈ ਸਪੈਸ਼ਲੀ ਵੈਡਿੰਗ ਦੇ ਲਈ ਟ੍ਰਡੀਸ਼ਨਲ ਕੋਰਥ ਆ ਜਿਹੜੇ ਉਹ ਤਿਆਰ ਕਰਦੇ ਆ ਠੀਕ ਹੈ ਮੈਮ ਤੁਸੀਂ ਮਤਲਬ ਹਾਂਜੀ ਹਾਂਜੀ ਮੈਮ ਸ਼ੋਅਰ ਤੁਸੀਂ ਬੈਠੋ ਮੈਂ ਤੁਹਾਨੂੰ ਵਿਖਾਨੀ ਹਾਂ ਸੈਂਪਲ ਮੈਮ ਤੁਸੀਂ ਪਹਿਲਾਂ ਦੱਸੋ ਤੁਸੀਂ ਕੀ ਲਓਗੇ ਚਾਹ ਲਓਗੇ ਕਿ ਕੋਫੀ ਓਕੇ ਮੈਮ ਮੈਮ ਮੈਂ ਤੁਹਾਨੂੰ ਸਟਾਰਟਿੰਗ ਤੋਂ ਆਪਣੇ ਸੈਂਪਲ ਦਿਖਾਉਂਦੀ ਹਾਂ ਸਭ ਤੋਂ ਪਹਿਲਾਂ ਮੈਮ ਤੁਸੀਂ ਕਿਹੜੇ ਕਲਰ ਕਿਹੜਾ ਚੂਜ਼ ਕੀਤਾ ਸੂਟ ਦਾ ਓਕੇ ਓਕੇ ਮੈਂ ਠੀਕ ਹੈ ਮੈਮ ਮੇਰ ਕੋਲ ਆਹ ਤਿੰਨ ਚਾਰ ਸੈਂਪਲ ਆ ਪਾਕਿਸਤਾਨ ਲੁੱਕ ਦੀ ਤੁਸੀਂ ਦੋਖੇ ਇਹਦੇ ਵਿੱਚ ਸਕਾਏ ਬਲਯੂ ਕਲਰ ਜਿਹੜਾ ਤੁਸੀਂ ਆਹ ਦੇਖ ਰਹੇ ਹੋ ਇਹ ਕਾਫੀ ਅੱਛਾ ਅਟਰੈਕਟੀਵ ਲੱਗ ਰਿਹਾ ਇਹਦੇ ਨੀਚੇ ਘੱਗਰਾ ਹੋਊਗਾ ਅਤੇ ਉੱਪਰ ਕਮੀਜ਼ ਹੋਊਗਾ ਪਲੱਸ ਇਹਦੇ ਨਾਲ ਫੁਲਕਾਰੀ ਦੇਖ ਲਓ ਤੁਸੀਂ ਬਹੁਤ ਸੋਹਣੀ ਅਟੈਚ ਹੋਈ ਹੋਈ ਆ ਤੁਹਾਨੂੰ ਇਹ ਡਿਜ਼ਾਇਨ ਪਸੰਦ ਆ ਹਾਂਜੀ ਮੈਮ ਤੁਸੀਂ ਆਹ ਦੇਖ ਸਕਦੇ ਹੋ ਸਾਡੇ ਕੋਲ ਨਿਊ ਮੋਡਰਨ ਜਿਹੜੀਆਂ ਲੈਸ਼ਿਸ਼ ਪਈਆਂ ਹੋਈਆਂ ਤੁਸੀਂ ਇਹਨਾਂ 'ਚੋਂ ਕੋਈ ਵੀ ਪਸੰਦ ਕਰ ਲਓ ਇਹਨਾਂ 'ਚੋਂ ਅਸੀਂ ਤੁਹਾਡੇ ਇੱਥੇ ਵਰਕ ਕਰ ਦਿਆਂਗੇ ਇਹਦੀ ਕੋਈ ਗੱਲ ਨਹੀਂ ਜਿਹੜੀ ਤੁਸੀਂ ਪਸੰਦ ਕਰੋਗੇ ਇਹਨਾਂ 'ਚ ਅਸੀਂ ਉਹੀ ਵਰਕ 'ਤੇ ਕਰ ਦਿਆਂਗੇ ਤੁਸੀਂ ਕਰ ਲਓ ਡਿਸਾਈਡ ਇਹ ਔਰ ਮੈਮ ਉਹ ਤੋਂ ਨੈਕਸਟ ਤੁਸੀਂ ਕਿਹੜਾ ਨੈਕਸਟ ਫੰਕਸ਼ਨ ਕਿਹੜਾ ਤੁਹਾਡਾ ਉਹ ਜਾਗੋ ਤੋਂ ਬਾਅਦ ਹਾਂਜੀ ਮੈਮ ਇਹਦੇ ਲਈ ਤਾਂ ਤੁਹਾਨੂੰ ਯੈਲੋ ਕੰਟਰਾਸਟ ਹੀ ਵਧੀਆ ਰਹੂਗਾ ਮੈਮ ਮੇਰੇ ਅਕੋਰਡਿੰਗ ਤੁਸੀਂ ਯੈਲੋ ਦੇ ਵਿੱਚ ਆ ਜਿਹੜਾ ਪੰਜਾਬੀ ਸੂਟ ਆ ਇਹ ਵਾਲਾ ਬਣਾਓ ਜਿਹਦੇ ਵਿੱਚ ਆ ਕਿ ਤੁਹਾਡਾ ਸਟਰੇਟ ਸਲਵਾਰ ਵਾਲਾ ਜਿਹੜਾ ਨਵਾਂ ਡਿਜ਼ਾਇਨ ਚੱਲਿਆ ਤੁਸੀਂ ਇਹ ਕੰਸੀਡਰ ਕਰੋ ਇਹਦੇ 'ਚ ਬਹੁਤ ਵਧੀਆ ਤੁਹਾਡਾ ਲੱਗੂਗਾ ਹਾਂਜੀ

ਓਕੇ ਓਕੇ ਮੈਮ ਕੋਈ ਗੱਲ ਨਹੀਂ ਇਹਦੇ 'ਚ ਤੁਹਾਨੂੰ ਅਸੀਂ ਆ ਜਿਹੜੇ ਨੈਟ ਡਿਜ਼ਾਇਨ ਇਹਨਾਂ 'ਚ

ਠੀਕ ਹੈ ਠੀਕ ਹੈ ਮੈਮ ਕੋਈ ਗੱਲ ਨਹੀਂ ਐਂਡ ਮੈਮ ਤੁਸੀਂ ਫਾਈਨਲ ਵਰੀ ਵਾਲਾ ਸੂਟ ਕਿਹੜਾ ਡਿਸਾਇਡ ਕੀਤਾ ਓਕੇ ਓਕੇ ਮੈਮ ਠੀਕ ਹੈ ਬਹੁਤ ਸੋਹਣਾ ਕਲਰ ਤੁਸੀਂ ਸੂਟ ਕੀਤਾ ਔਰ ਮੈਮ ਤੁਹਾਨੂੰ ਮੈਂ ਦੱਸ ਦੇਵਾਂ ਇਹ ਕਲਰ ਦਾ ਅੱਜ ਕੱਲ੍ਹ ਡਿਜ਼ਾਇਨ ਵੀ ਕਾਫੀ ਅੱਛਾ ਹੈ ਪੈ ਰਿਹਾ ਔਰ ਪੋਟਰੀ ਵਰਕ ਆ ਜਿਹੜਾ ਇਸ ਕਲਰ 'ਤੇ ਬਹੁਤ ਵਧੀਆ ਆ ਰਿਹਾ ਤੁਹਾਨੂੰ ਮੈਮ ਇਹ ਤੁਸੀਂ ਸਿੰਪਲ ਹਾਂਜੀ ਹਾਂਜੀ ਮੈਮ ਸ਼ੋਅਰ ਤੁਹਾਨੂੰ ਇਹ ਚੀਜ਼ ਵੀ ਸਾਡੇ ਕੋਲ ਮਿਲ ਜਾਏਗੀ ਔਰ ਮੈਮ ਇੱਕ ਤੁਹਾਨੂੰ ਇਹ ਅਸੀਂ ਇਹ ਗੱਲ ਕਹਿਣੀ ਸੀਗੀ ਤੁਸੀਂ ਆਪਣਾ ਜਿਹੜਾ ਓਰਡਰ ਆ ਕਿੰਨੇ ਟਾਈਮ ਪਹਿਲਾਂ ਲੈਣਾ ਚਾਹੁੰਦੇ ਹੋ ਵੈਡਿੰਗ ਹਾਂਜੀ ਹਾਂਜੀ ਮੈਮ ਠੀਕ ਹੈ ਮੈਮ ਤੁਹਾਨੂੰ ਅਸੀਂ ਟੈਨ ਡੇਅ ਪਹਿਲਾਂ ਹੀ ਦੇ ਦਿਆਂਗੇ ਇਹ ਚੀਜ਼ ਤੁਸੀਂ ਆਪਣੇ ਜਿਹੜੇ ਇਹ ਸੂਟ ਨਾਲ ਇਹ ਤੁਸੀਂ ਪਜਵਾ ਸਕਦੇ ਹੋ ਸਾਨੂੰ ਕੱਲ੍ਹ ਹੀ ਭਾਵੇਂ ਤੁਸੀਂ ਸਾਨੂੰ ਦੇ ਜਾਣਾ ਔਰ ਇਸ ਤੋਂ ਬਾਅਦ ਤੁਹਾਨੂੰ ਅਸੀਂ ਦਸ ਦਸ ਦਿਨ ਵੈਡਿੰਗ ਤੋਂ ਪਹਿਲਾਂ ਓਰਡਰ ਤੁਹਾਡਾ ਪੂਰੀ ਤਰ੍ਹਾ ਤਿਆਰ ਹੋਊਗਾ ਠੀਕ ਹੈ ਮੈਮ ਔਰ ਮੈਮ ਜੋ ਬਿਲਿੰਗ ਦਾ ਹੋਏਗਾ ਫਿਰ ਉਹ ਤੁਹਾਨੂੰ ਅਸੀਂ ਕੱਲ੍ਹ ਹੀ ਅਕੋਰਡਿੰਗ ਟੂ ਡਿਜ਼ਾਇਨ ਦੱਸ ਦਿਆਂਗੇ ਓਕੇ ਮੈਮ ਠੀਕ ਹੈ ਥੈਂਕ ਯੂ ਮੈਮ ਠੀਕ ਹੈ ਜੀ ਓਕੇ ਜੀ